ਹਰ ਸੰਗੀਤ ਸ਼ੈਲੀ ਦੀ ਆਪਣੀ ਖ਼ਾਸੀਅਤ ਹੁੰਦੀ ਹੈ ਅਤੇ ਸਭ ਤੋਂ ਵਧੀਆ ਸ਼ੈਲੀ ਜੋ ਮੈਨੂੰ ਲੱਗਦੀ ਹੈ ਉਹ ਹੈ ਸ਼ਾਸਤਰੀ ਸੰਗੀਤ ਜਿਵੇਂ ਕਿ ਉਹਦੇ ਵਿੱਚ ਆਪਣੀ ਤਕਨੀਕੀ ਨਿਪੂੰਨਤਾ ਭਾਵਨਾਤਮਕ ਗਹਿਰਾਈ ਅਤੇ ਪ੍ਰੰਪਰਾਗਤ ਵਿਸਾਰਤ ਕੀਤੀ ਜਾਂਦੀ ਹੈ ਕਈ ਲੋਕਾਂ ਲਈ ਪ੍ਰੇਰਨ ਪ੍ਰੇਰਨਾ ਦਾ ਸਰੋਤ ਹੁੰਦਾ ਹੈ ਹੋਰ ਬਹੁਤ ਸਾਰੀਆਂ ਸ਼ੈਲੀਆਂ ਹੁੰਦੀਆਂ ਹਨ ਜਿਵੇਂ ਕਿ ਲੋਕ ਸੰਗੀਤ ਪਾਪ ਅਤੇ ਰਾਕ ਸੰਗੀਤ ਲੋਕ ਸੰਗੀਤ ਆਪਣੀ ਅਸਲ ਸਰਲਤਾ ਸੱਚਾਈ ਅਤੇ ਸਥਾਨੀ ਕਥਾਵਾਂ ਨੂੰ ਜੀਵਤ ਕਰਨ ਦੀ ਵਜ੍ਹਾ ਨਾਲ ਖ਼ਾਸ ਮਾਨਿਆ ਜਾਂਦਾ ਹੈ ਪਾਪ ਅਤੇ ਰੋਕ ਸੰਗੀਤ ਆਪ ਆਪਣੇ ਆਧੁਨਿਕਤੀਆਂ ਉਜਰਾ ਅਤੇ ਵਿਆਪਕ ਅਪੀਲ ਕਰਕੇ ਯੁਵਾ ਪੀੜੀ ਦੇ ਵਿੱਚ ਲੋਕਪ੍ਰਿਅ ਹੁੰਦੇ ਹਨ ਮੈਨੂੰ ਸ਼ਾਸਤਰੀ ਸੰਗੀਤ ਅਤੇ ਪੋਪ ਅਤੇ ਰੋਕ ਸੰਗੀਤ ਬਹੁਤ ਜ਼ਿਆਦਾ ਪਸੰਦ ਹਨ ਅਤੇ ਇਸ ਲਈ ਪਸੰਦ ਹਨ ਕਿਉਂਕਿ ਮੈਂ ਖੁਦ ਇਸ ਹੀ ਸਥਿਤੀ ਦੇ ਵਿੱਚ ਰਹਿੰਦੀ ਹਾਂ ਜਿਸ ਵਿੱਚ ਕਿ ਪੋਪ ਸੰਗੀਤ ਬਹੁਤ ਜ਼ਿਆਦਾ ਮਸ਼ਹੂਰ ਹੈ ਮੈਨੂੰ ਸਾਰੇ ਸੰਗੀਤ ਸ਼ੈਲੀਆਂ ਪਸੰਦ ਹਨ ਕਿਉਂਕਿ ਹਰ ਕਿਸੇ ਦੀ ਆਪਣੀ ਖੂਬਸੂਰਤੀ ਅਤੇ ਮਹਿਸੂਸਾਤਮਕ ਪ੍ਰਭਾਵ ਹੁੰਦਾ ਹੈ ਜੇਕਰ ਤੁਸੀਂ ਆਪਣੇ ਗਾਇਕ ਬਣਨ ਦੀ ਕਹਾਣੀ ਜਾਂ ਪ੍ਰੇਰਨਾ ਬਾਰੇ ਗੱਲ ਕਰਨਾ ਚਾਹੁੰਦੇ ਹੋ ਤਾਂ ਮੈਂ ਖੁਸ਼ੀ ਖੁਸ਼ੀ ਸੁਣੂੰਗੀ ਅਤੇ ਸ਼ੈਲੀਆਂ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕਰੂੰਗੀ ਇਸ ਕਰਕੇ ਮੇਰੇ ਵਿੱਚ ਰੂਚਮਤੀਕਤਾ ਪ੍ਰੋ